ਮੈਂ ਚਿੱਤਰਕਾਰੀ ਦੀ ਕਲਾਸ ਔਨਲਾਈਨ ਲਗਾਈ ਹੈ ਅਤੇ ਮੈਂ ਔਨਲਾਈਨ ਔਨਲਾਈਨ ਚਿੱਤਰਕਾਰੀ ਦੀ ਕਲਾਸ ਲਗਾਉਣ ਨਾਲ ਹੀ ਲਗਾਉਣ ਨਾਲ ਹੀ ਮੇਰੇ 'ਚ ਇੰਟਰਸਟ ਬਣਿਆ ਹੈ ਜਿਸ ਕਰਕੇ ਕਿ ਮੈਂ ਔਨਲਾਈਨ ਕਲਾਸਿਸ ਲਗਾ ਲਗਾ ਕੇ ਪ੍ਰੈਕਟਿਸ ਕਰ ਕਿ ਮੈਂ ਖੁਦ ਪ੍ਰੈਕਟਿਸ ਕਰਕੇ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਹੈ ਅਤੇ ਉਸ ਤੋਂ ਬਾਅਦ ਮੈਂ ਅਤੇ ਉਸ ਤੋਂ ਬਾਅਦ ਹੀ ਮੈਂ ਸਕੂਲਾਂ ਵਿੱਚ ਮੈਡਮਾਂ ਦੁਆਰਾ ਚਿੱਤਰਕਾਰੀ ਸਿੱਖੀ ਹੈ ਅਤੇ ਅਗਰ ਕਦੇ ਸਕੂਲਾਂ ਵਿੱਚ ਫ੍ਰੀ ਟਾਈਮ ਮੈਂ ਚਿੱਤਰਕਾਰੀ ਕਰਦੀ ਰਹੀ ਹਾਂ ਅਤੇ ਉਸ ਤੋਂ ਬਾਅਦ ਅਗਰ ਛੁੱਟੀ ਵਾਲੇ ਦਿਨ ਵੀ ਮੈਂ ਮੈਮ ਕੋਲੋਂ ਜਾ ਕੇ ਚਿੱਤਰਕਾਰੀ ਦੀ ਕਲਾਸਿਸ ਲਾਉਂਦੀ ਰਹੀ ਹਾਂ ਅਤੇ ਸਿੱਖਦੀ ਰਹੀ ਹਾਂ ਮੈਮ ਕੋਲੋਂ ਅਤੇ ਅਤੇ ਔਫਲਾਈਨ ਅਤੇ ਔਫਲਾਈਨ ਵੀ ਮੈਂ ਆਪਣੇ ਘਰ ਵੀ ਮੈਂ ਦੀ ਆਪਣੇ ਦੀਦੀ ਕੋਲੋਂ ਕਲਾਸਿਸ ਲਈਆਂ ਹਨ ਮੈਂ ਉਨ੍ਹਾਂ ਤੋਂ ਕੁਛ ਨਾ ਕੁਛ ਬਣਾਉਣਾ ਸਿੱਖਿਆ ਹੈ ਜਿਸ ਕਰਕੇ ਕਿ ਮੇਰੇ 'ਚ ਮੇਰੀ ਚਿੱਤਰਕਾਰੀ 'ਚ ਸੁਧਾਰ ਹੋਇਆ ਹੈ